ਸਤਿ ਸ਼੍ਰੀ ਅਕਾਲ ਜੀ ਮੈਂ ਅਨੂ ਸ਼ਰਮਾ ਬੋਲ ਰਹੀ ਹਾਂ ਮੈਂ ਤੁਹਾਡੇ ਰੈਸਟੋਰੈਂਟ ਡੋਮੀਨੋਜ਼ ਤੋਂ ਇੱਕ ਪੀਜਾ ਔਡਰ ਕੀਤਾ ਸੀ ਬਟ ਕੁਛ ਕਾਰਨ ਕਰਕੇ ਮੈਨੂੰ ਉਹਨੂੰ ਕੈਂਸਲ ਕਰ ਦਿੱਤਾ ਜਾਣਾ ਪਿਆ ਬਟ ਤੇ ਮੈਂ ਉਸਦੀ ਜਿਹੜੀ ਪੇਮੈਂਟ ਸੀਗੀ ਉਹ ਭੁਗਤਾਨ ਮੈਂ ਔਨਲਾਈਨ ਕਰ ਦਿੱਤਾ ਸੀਗਾ ਅਤੇ ਹਜੇ ਤੱਕ ਮੈਨੂੰ ਉਸ ਦਾ ਜੋ ਵੀ ਪੇਮੈਂਟ ਖਾਤਾ ਰਿਫੰਡ ਸੀਗਾ ਉਹ ਹਜੇ ਤੱਕ ਮੇਰੇ ਖਾਤੇ ਦੇ ਵਿੱਚ ਨਹੀਂ ਆਇਆ ਤਾਂ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਮੇਰੇ ਖਾਤੇ ਦੇ ਵਿੱਚ ਮੇਰੀ ਕੱਟੀ ਗਈ ਰਾਮ ਅ ਰਕਮ ਛੇਤੀ ਤੋਂ ਛੇਤੀ ਟਰਾਂਸਫਰ ਕਰ ਦਿੱਤੀ ਜਾਵੇ